ਹੈਲੋ ਹੈਲੋ ਹਾਂਜੀ ਹਾਂ ਠੀਕ ਠਾਕ ਤੁਸੀਂ ਸੁਣਾਓ ਅੱਛਿਆ ਹਾਂ ਵੈਜੀਟੇਰੀਅਨ ਮੈਂ ਖੁਦ ਵੀ ਵੈਜੀਟੇਰੀਅਨ ਹੈ ਪਰ ਮੈਂ ਸਗੋਂ ਸਮਝਦਾ ਕਿ ਵੈਜੀਟੇਰੀਅਨ ਜ਼ਿਆਦਾ ਅੱਛਾ ਹੈ ਡਾਇਟ ਜਿਹੜੀ ਹੈ ਪੋਜੀਟਿਵ ਡਾਇਟ ਹੈ ਇੱਕ ਕਿਉਂਕੀ ਜਿਹੜੇ ਨੋਨ ਵੈਜੀਟੇਰੀਅਨ ਜਾਂ ਦੂਸਰੇ ਸੋਰਸਿਜ਼ ਅਸੀਂ ਯੂਸ ਕਰਦੇ ਹਾਂ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਉਹਨਾਂ ਦੇ ਕੁਛ ਸਾਈਡ ਇਫੈਕਟ ਸੀ ਨੁਕਸਾਨ ਵੀ ਹੁੰਦੇ ਹੈ ਬੋਡੀ ਉੱਤੇ ਕੁਛ ਮਾੜਾ ਅਸਰ ਕਰਦੇ ਲੋਂਗ ਰਨ 'ਚ ਅਤੇ ਜਿਹੜੀਆਂ ਹੈਗੀਆਂ ਆਪਣੀਆਂ ਸਗੋਂ ਘਰੇਲੂ ਜਿਹੜੀਆਂ ਚੀਜ਼ਾਂ ਹੈਗੀਆਂ ਵਾ ਦਾਲਾਂ ਸਬਜ਼ੀਆਂ ਜਿਹੜੀਆਂ ਆਮ ਯੂਸ ਕਰਦੇ ਹਾਂ ਅੱਛੀਆਂ ਉਹ ਪ੍ਰੋਟੀਨ ਵਾਸਤੇ ਸੋਰਸ ਹੈ ਪਨੀਰ ਹੈ ਅਤੇ ਸੋ ਮਤਲਬ ਜਿਹੜੇ ਘਰੇਲੂ ਸੋਰਸਿਸ ਹੈਗੇ ਹੈ ਇਹ ਜ਼ਿਆਦਾ ਬੈਨੀਫਿਸ਼ਅਲ ਹੈ ਇਹਦੇ ਨਾਲ ਬੋਡੀ ਜਿਹੜੀ ਹੈ ਬਿਲਕੁਲ ਨੋਰਮਲ ਰਹਿੰਦੀ ਹੈ ਨੋਰਮਲ ਵੇ ਨਾਲ ਡਿਵੈਲਪ ਕਰਦੀ ਹੈ ਹਾਂ ਦੁੱਧ ਜਿਹੜੀ ਤੁਸੀਂ ਡਾਇਟ ਜਿਹੜੀ ਘਰ 'ਚ ਵਰਤਦੇ ਨਾ ਚੰਗੀ ਉਹ ਬੜੀ ਅੱਛੀ ਸਿਹਤ ਵਾਸਤੇ ਉਹ ਹੀ ਪ੍ਰਫੈਕਟ ਹੈਗੀ ਹੈ ਅਤੇ ਬਿਲਕੁਲ ਤੁਸੀਂ ਇਸਨੂੰ ਪ੍ਰੈਫਰ ਰੱਖੋ ਚਲੋ ਠੀਕ ਆ ਫਿਰ ਓਕੇ ਜੀ